ਬੰਗਾਲੀ ਅਤੇ ਪੰਜਾਬੀ ਦੋਵੇਂ ਵੱਖ ਵੱਖ ਮੂ਼ਲ ਅਤੇ ਭਾਸ਼ਾਈ ਵਿਸ਼ੇਸ਼ਤਾਵਾਂ ਵਾਲੀਆਂ ਦੋ ਵੱਖਰੀਆਂ ਭਾਸ਼ਾਵਾਂ ਹਨ ਬੰਗਾਲੀ ਇੱਕ ਇੰਡੋ ਆਰੀਅਨ ਭਾਸ਼ਾ ਹੈ ਜੋ ਮੁੱਖ ਤੌਰ 'ਤੇ ਭਾਰਤ ਅਤੇ ਬਾਂਗਲਾਦੇਸ਼ ਵਿੱਚ ਬੋਲੀ ਜਾਂਦੀ ਹੈ ਖਾਸ ਕਰਕੇ ਬਾਂਗਲਾਦੇਸ਼ ਵਿੱਚ ਇਹ ਭਾਸ਼ਾ ਬੋਲੀ ਜਾਂਦੀ ਹੈ ਦੂਜੇ ਪਾਸੇ ਪੰਜਾਬੀ ਪੰਜਾਬ ਖੇਤਰ ਵਿੱਚ ਬੋਲੀ ਜਾਂਦੀ ਹੈ ਅਤੇ ਇਹ ਭਾਸ਼ਾ ਪਾਕਿਸਤਾਨ ਅਤੇ ਭਾਰਤ ਵਿੱਚ ਵੰਡੀ ਹੋਈ ਹੈ ਜਦੋਂ ਕਿ ਦੋਵੇਂ ਭਾਸ਼ਾਵਾਂ ਇੰਡੋ ਆਰੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਿਤ ਹਨ ਉਹਨਾਂ ਲਈ ਧੁਨੀ ਵਿਆਕਰਨ ਅਤੇ ਸ਼ਬਦਾਵਲੀ ਦੀਆਂ ਵਿਸ਼ੇਸ਼ਤਾਵਾਂ ਹਨ ਬੰਗਾਲੀ ਆਪਣੇ ਅਮੀਰ ਸਾਹਿਤਕ ਪਰੰਪਰਾ ਲਈ ਜਾਣੀ ਜਾਂਦੀ ਹੈ ਅਤੇ ਬਾਂਗਲਾਦੇਸ਼ ਦੀ ਅਧਿਕਾਰਤ ਭਾਸ਼ਾ ਹੈ ਜਦੋਂ ਕਿ ਪੰਜਾਬੀ ਦੀ ਭਾਰਤ ਅਤੇ ਪਾਕਿਸਤਾਨ ਦੋਵਾਂ ਵਿੱਚ ਮਹੱਤਪੂਰਨ ਮੌਜੂਦਗੀ ਹੈ ਅਤੇ ਇਹ ਆਪਣੀ ਸੱਭਿਆਚਾਰਕ ਅਤੇ ਸਾਹਿਤਕ ਵਿਰਾਸਤ ਲਈ ਵੀ ਜਾਣੀ ਜਾਂਦੀ ਹੈ ਸੰਕੇਤ ਰੂਪ ਵਿੱਚ ਬੰਗਾਲੀ ਅਤੇ ਪੰਜਾਬੀ ਆਪਣੀਆਂ ਵਿਲੱਖਣ ਵਿਸ਼ੇਸ਼ਤਾਵਾਂ ਵਾਲੀਆਂ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਹਨ ਹਾਲਾਂਕਿ ਇਹ ਇੰਡੋ ਆਰੀਅਨ ਭਾਸ਼ਾ ਪਰਿਵਾਰ ਵਿੱਚ ਆਪਣੇ ਸਾਂਝੇ ਵੰਸ਼ ਦੇ ਕਾਰਨ ਕੁਝ ਸਮਾਨਤਾਵਾਂ ਸਾਂਝੀਆਂ ਕਰ ਸਕਦੇ ਹਨ